ਹੈਲੋ ਸਤਿ ਸ਼੍ਰੀ ਕਾਲ ਮੈਮ ਕੀ ਹਾਲ ਚਾਲ ਹੈ ਹਾਂਜੀ ਬਸ ਵਧੀਆ ਮੈਮ ਕਿੱਦਾਂ ਚੱਲ ਰਹੀ ਹਾਂ ਤੁਹਾਡੇ ਵੱਲ ਐਡਮਿਸ਼ਨਸ

ਸਾਡੇ ਵੱਲ ਕੰਪਿਊਟਰ ਐਪਲੀਕੇਸ਼ਨ ਕਰਕੇ ਐਡਮਿਸ਼ਨ ਵਧੀਆ ਚੱਲਦੀਆਂ ਪਈਆਂ ਏ ਆ ਕਿਉਂਕਿ ਅੱਜ ਕੱਲ ਬੱਚੇ ਜ਼ਿਆਦਾਤਰ ਕੰਪਿਊਟਰ ਲਾਈਨ ਦੇ ਵੱਲ ਜ਼ਿਆਦਾ ਜਾ ਰਹੇ ਆ ਡਿਜੀਟਲ ਜ਼ਮਾਨਾ ਹੋਣ ਕਰਕੇ ਠੀਕ ਆ ਫਿਰ ਸਿਟਿੰਗ ਜੋਬ ਵੀ ਬੱਚੇ ਜ਼ਿਆਦਾ ਕਰਨਾ ਪ੍ਰੈਫਰ ਕਰਦੇ ਆ ਘੁੰਮਣ ਫਿਰਨ ਨਾਲੋਂ ਇਸ ਕਰਕੇ ਸਾਡੇ ਵੱਲ ਤਾਂ ਜੌ ਜਿਹੜੀਆਂ ਐਡਮਿਸ਼ਨਸ ਕਾਫੀ ਵਧੀਆ ਚੱਲਦੀ ਪਈਆ ਹਾਂਜੀ ਇਸ ਕਰਕੇ ਮੈਮ ਜਿਹੜੀਆਂ ਸਿਟਿੰਗ ਜੋਬਸ ਕਰਕੇ ਉਹਦੀ ਪ੍ਰੈਫਰੈਂਸ ਵਧਨ ਕਰਕੇ ਜ਼ਿਆਦਾ ਹੋ ਰਿਹਾ ਵਾ ਗੱਲ ਮਕੈਨੀਕਲ ਇੰਜੀਨੀਅਰਿੰਗ ਦੀ ਗੱਲ ਕੀਤੀ ਜਾਵੇ ਅਤੇ ਇੱਧਰ ਵੀ ਬਹੁਤ ਹੀ ਘੱਟ ਐਡਮਿਸ਼ਨ ਇਸ ਸਾਲ ਫਾਰਮੇਸੀ ਸਾਈਡ ਤਾਂ ਠੀਕ ਠੀਕ ਐਡਮਿਸ਼ਨਸ ਆ ਕਿਉਂਕਿ ਮੈਡੀਕਲ ਸਟੂਡੈਂਟਸ ਮੋਸਟਲੀ ਹੁਣ ਬੀ ਐਸ ਸੀ ਨਰਸਿੰਗ ਤੋਂ ਬਜਾਏ ਫਾਰਮੈਸੀ ਲਾਈਨ ਦੇ ਵਿੱਚ ਜ਼ਿਆਦਾ ਆ ਰਹੇ ਆ ਹਾਂਜੀ ਹਾਂਜੀ ਹਾਂਜੀ ਅਤੇ ਕਈ ਬੱਚੇ ਜਿਹੜੇ ਫੋਰਨ ਦਾ ਪਲੈਨ ਕਰਦੇ ਪਏ ਆ ਅਤੇ ਉਹ ਹੋਟਲ ਮੈਨੇਜਮੈਂਟ ਵੱਲ ਡਿਪਲੋਮੇ ਕੋਰਸਿਸ ਵੀ ਕਰਦੇ ਪਏ ਆ ਅਮੈਰੀਕਨ ਵੀ 'ਚ ਵੀ ਡਿਪਲੋਮੇ ਆ ਰਹੇ ਆ ਹਾਂਜੀ ਹਾਂਜੀ ਹੋਰ ਮੈਮ ਸਭ ਕੋਲੇਜ ਦਾ ਕੰਮ ਠੀਕ ਚੱਲ ਰਿਹਾ ਏ ਆ ਓਕੇ ਮੈਮ ਚਲੋ ਠੀਕ ਆ ਫਿਰ ਆਪਾਂ ਫਿਰ ਕੋਲ ਕਰਾਂਗੇ